ਪੰਜਾਬ ਦੀ ਸਿੱਖਿਆ ਪ੍ਰਣਾਲੀ ਬਹੁਤ ਹੀ ਪੁਰਾਣੀ ਯੋਜਨਾਵਾਂ ਅਧੀਨ ਚੱਲਦੀ ਆ ਰਹੀ ਹੈ ਪੰਜਾਬ ਅਤੇ ਭਾਰਤ ਵਿੱਚ ਪਾਸ ਪ੍ਰਤੀਸ਼ਤਾ ਤੇਤੀ ਪ੍ਰਸੈਂਟ ਹੈ ਜਿਸ ਨੂੰ ਵਧਾ ਕੇ ਸਾਨੂੰ ਘੱਟੋ ਘੱਟ ਪੰਜਾਹ ਤਾਂ ਕਰਨਾ ਹੀ ਚਾਹੀਦਾ ਹੈ ਕਿਉਂਕਿ ਲੋਕ ਇਹ ਸੋਚਦੇ ਹਨ ਕਿ ਉਹ ਸਿਰਫ਼ ਤੇਤੀ ਪਰਸੈਂਟ ਨੰਬਰ ਲੈ ਕੇ ਹੀ ਪਾਸ ਹੋ ਜਾਣ ਉਹ ਆਪਣੇ ਆਪ ਨੂੰ ਉਸ ਛੋਟੀ ਸੋਚ ਨੂੰ ਹੀ ਲੈ ਕੇ ਅੱਗੇ ਵੱਧਦੇ ਰਹਿੰਦੇ ਹਨ ਜੇ ਉਹ ਜ਼ਿਆਦਾ ਪਾਸ ਪ੍ਰ ਪਾਸ ਪ੍ਰਤੀਸ਼ਤਾ ਲਈ ਅੱਗੇ ਅੱਗੇ ਜਾਣਗੇ ਤਾਂ ਹੀ ਉਹ ਆਪਣੀ ਸੋਚ ਅਤੇ ਆਪਣੇ ਗਿਆਨ ਨੂੰ ਵਧਾ ਸਕਣਗੇ